ਸਤਿ ਸ੍ਰੀ ਅਕਾਲ ਭਾਅ ਜੀ ਕੀ ਹਾਲ ਚਾਲ ਹੈ ਜੀ ਭਾਅ ਜੀ ਮੈਂ ਪੰਦਰਾਂ ਦਿਨ ਪਹਿਲਾਂ ਤੁਹਾਡੇ ਕੋਲੋਂ ਨੁਆਇਸ ਦੇ ਹੈੱਡਫੋਨ ਮੰਗਵਾਏ ਤੇ ਜੀ ਕਾਲੇ ਰੰਗ ਦੇ ਪਰ ਭਾਅ ਜੀ ਜਦ ਮੇਰਾ ਔਰਡਰ ਆਇਆ ਜੀ ਜਦ ਮੈਂ ਲਿਫਾਫਾ ਖੋਲ੍ਹਿਆ ਪਹਿਲਾਂ ਤਾਂ ਔਰਡਰ ਏ ਪੰਦਰਾਂ ਦਿਨ ਕਿਹਾ ਲਿਖਿਆ ਵਿਆ ਤਾ ਜੀ ਮਹੀਨੇ ਬਾਅਦ ਔਰਡਰ ਆਇਆ ਜੀ ਮੇਰਾ ਅਤੇ ਜਦੋਂ ਮੈਂ ਪੈਕਟ ਖੋਲ੍ਹਿਆ ਜੀ ਡਿਲੀਵਰੀ ਵਾਲ਼ਾ ਅਤੇ ਮੈਂ ਮੰਗਵਾਏ ਸੀਗੇ ਕਾਲੇ ਰੰਗ ਦੇ ਨਿਕਲ਼ੇ ਉਹ ਚਿੱਟੇ ਰੰਗ ਦੇ ਜੀ ਜਦੋਂ ਉਹਨਾਂ ਨੂੰ ਮੈਂ ਯੂਜ਼ ਕੀਤਾ ਵੋਇਸ ਵੀ ਉਹਨਾਂ ਦੀ ਬੜੀ ਖਰਾਬ ਤੀ ਜੀ ਠੀਕ ਹੈ ਚਾਰਜਿੰਗ ਵੀ ਬੜੀ ਲੌ ਸੀਗੀ ਘੱਟੋ ਘੱਟ ਮੈਂ ਕਹਿੰਦਾ ਘੰਟਾ ਹੀ ਕੱਢਦੇ ਸੀਗੇ ਜੀ ਅਤੇ ਉਹਨਾਂ ਦੀ ਜਿਹੜੀ ਰਬੜ ਵਗੈਰਾ ਸੀਗੀ ਇੱਕ ਹੈੱਡਫੋਨ ਦੀ ਤਾਂ ਰਬੜ ਏ ਨਹੀਂ ਤੀ ਜੀ ਨਾ ਕੋਈ ਐਕਸਟਰਾ ਰਬੜ ਸੀਗੀ ਕਿ ਮੈਂ ਉਹਨੂੰ ਨਵੀਂ ਪਾ ਲੈਂਦਾ ਜੀ ਬੜੀ ਘਟੀਆ ਕੁਆਲਿਟੀ ਸੀਗੀ ਜੀ ਬੜਾ ਜਮਾ ਹੀ ਬੇਕਾਰ ਲੱਗਿਆ ਠੀਕ ਹੈ ਜੀ ਅਤੇ ਤੁਸੀਂ ਪੈਸੇ ਵੀ ਬਹੁਤ ਜ਼ਿਆਦਾ ਲੈ ਲਏ ਜੀ ਮਾਰਕਿਟ ਰੇਟ ਨਾਲੋਂ ਵੀ ਦੁੱਗਣੇ ਪੈਸੇ ਲੈ ਲਏ ਜੀ ਤੁਸੀਂ ਬਹੁਤ ਘਟੀਆ ਕੁਆਲਿਟੀ ਦੇ ਹੈੱਡਫੋਨ ਤੇ ਜੀ ਜਮਾ ਹੀ ਖਰਾਬ ਅਗਲੀ ਵਾਰ ਤੋਂ ਇਹ ਇਹੋ ਜੇ ਹੈੱਡਫੋਨ ਮੰਗਵਾਉਣੇ ਨਹੀਂ ਜੀ ਇਹੀ ਗੱਲ ਕਹਿਣੀ ਤੀ ਜੀ ਤੁਹਾਨੂੰ